ਪੰਜਾਬੀ ਭਾਸ਼ਾ ਦੀ ਵਿਲੱਖਣਤਾ ਦੀ ਗੱਲ ਕਰੀਏ ਤਾਂ ਇਹ ਸੱਚ ਮੁੱਚ ਬੜੀ ਦਿਲਚਸਪ ਭਾਸ਼ਾ ਹੈ ਇਹਦੇ ਜਿਹੜੇ ਛੱਬੀ ਅੱਖਰ ਹੈਗੇ ਨੇ ਤਾਂ ਅਸੀਂ ਕਹਿ ਸਕਦੇ ਹਾਂ ਵੀ ਇਹਦੇ 'ਚ ਅਸੀਂ ਜਿਹੜਾ ਵੀ ਸ਼ਬਦ ਚਾਹੀਏ ਉਹ ਅਸੀਂ ਬੋਲ ਸਕਦੇ ਹਾਂ ਜਿਵੇਂ ਅੰਗਰੇਜ਼ੀ ਦੀ ਗੱਲ ਕਰੀਏ ਤਾਂ ਬੜੇ ਸਾਰੇ ਸ਼ਬਦ ਇਹੋ ਜਿਹੇ ਨੇ ਜਿਹੜੇ ਅੰਗਰੇਜ਼ੀ ਦੇ ਵਿੱਚ ਆਪਾਂ ਰਾਰਾ ੜਾੜਾ ਇਹਦੇ 'ਚ ਜਿਹੜੀ ਵਿਭਿੰਨਤਾ ਬੜੀ ਆ ਉਹ ਅੰਗਰੇਜ਼ੀ ਦੇ ਵਿੱਚ ਅਸੀਂ ਦਰਸਾ ਨੀ ਸਕਦੇ ੜਾੜਾ ਤੇ ਰਾਰੇ ਦਾ ਫਰਕ ਅਸੀਂ ਦੱਸ ਨਹੀਂ ਸਕਦੇ ਉੱਥੇ ਉਹੀ ਲਿਖਣਾ ਪਊਗਾ ਅਤੇ ਪੰਜਾਬੀ ਦੇ ਵਿੱਚ ਅਸੀਂ ਗੱਲ ਕਰੀਏ ਵੀ ਅਸੀਂ ਜਿਹੜਾ ਵੀ ਸ਼ਬਦ ਅਸੀਂ ਬੋਲਣਾ ਚਾਹੁੰਦੇ ਹਾਂ ਤਾਂ ਅਸੀਂ ਉਹੀ ਅੱਖਰ ਲਿਖ ਕੇ ਉਹਨੂੰ ਦਰਸਾ ਦਿੰਦੇ ਹਾਂ ਬਿੰਦੀ ਅਤੇ ਟਿੱਪੀ ਦੇ ਨਾਲੇ ਬੜਾ ਫਰਕ ਪੈ ਜਾਂਦਾ ਜੇ ਅਸੀਂ ਬਿੰਦੀ ਕੋਈ ਸ਼ਬਦ ਨੂੰ ਦਰਸਾਉਣ ਲਈ ਕਿਤੇ ਅਸੀਂ ਬਿੰਦੀ ਪਾ ਕੇ ਉਹਦਾ ਅਰਥ ਅਤੇ ਜਿਹੜਾ ਉਚਾਰਣ ਆ ਉਹ ਬਦਲ ਜਾਂਦਾ ਹੈ ਸੱਸੇ ਅਤੇ ਛੱਛੇ ਦਾ ਫਰਕ ਹੈ ਜਿਹੜਾ ਸੱਸੇ ਦੇ ਪੈਰ 'ਚ ਬਿੰਦੀ ਪਾ ਦਈਏ ਤਾਂ ਉਹ ਛੱਛਾ ਬਣ ਜਾਂਦਾ ਜੇ ਅਸੀਂ ਨਹੀਂ ਪਾਉਂਦੇ ਤਾਂ ਉਹ ਸੱਸਾ ਰਹਿੰਦਾ ਇਸੇ ਤਰ੍ਹਾਂ ਨਾਲ ਕਿਸੇ ਚੀਜ਼ ਨੂੰ ਅਸੀਂ ਬੜਾ ਉਹਦੇ ਨਾਲ ਦੱਸਣਾ ਹੈ ਵੀ ਹਾਂ ਬੱਸ ਰੁਕ ਕੇ ਠਹਿਰਾਅ ਦੇਣਾ ਤਾਂ ਉਹਦੇ 'ਤੇ ਅੱਧਕ ਪਾ ਦੇਈਏ ਉਹ ਸਾਡਾ ਜਿਹੜਾ ਹੈਗਾ ਬੱਬਾ ਸੱਸਾ ਬਸ ਬਣ ਜਾਂਦਾ ਬੱਬੇ ਤੇ ਅੱਧਕ ਪਾ ਦੇਈਏ ਤਾ ਉਹ ਬੱਸ ਬਣ ਜਾਂਦਾ ਇਸ ਕਰਕੇ ਜਿਹੜੀ ਇਹ ਪੰਜਾਬੀ ਭਾਸ਼ਾ ਇਹ ਸਾਨੂੰ ਬੜੀ ਵਧੀਆ ਲੱਗਦੀ ਹੈ ਜਿਹਦੇ ਨਾਲ ਵੀ ਤੁਸੀਂ ਕੋਈ ਵੀ ਤੁਹਾਡੇ 'ਚ ਬੜੀ ਅਜ਼ਾਦੀ ਹੈ ਵੀ ਤੁਸੀਂ ਕਿਸੇ ਤਰ੍ਹਾਂ ਨਾਲ ਕੋਈ ਆਪਣਾ ਜਿਹੜਾ ਕੁਛ ਤੁਹਾਡੇ ਦਿਲ ਦੇ ਭਾਵ ਨੇ ਤੁਸੀਂ ਉਹ ਦੱਸ ਸਕਦੇ ਹੋ ਇਹਦੇ ਨਾਲ ਲਿਖ ਸਕਦੇ ਹੋ ਜਦੋਂ ਕਿ ਜੇ ਅਸੀਂ ਹੋਰਾਂ ਭਾਸ਼ਾ ਦੀ ਗੱਲ ਕਰੀਏ ਤਾਂ ਉਹਦੇ ਜਿਹੜਾ ਹੈਗਾ ਅਸੀਂ ਇੰਨਾ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਦਰਸਾ ਨਹੀਂ ਸਕਦੇ ਕਿਉਂਕਿ ਉਹ ਸਾਡੇ ਕੋਲ ਸ਼ਬਦ ਨਹੀਂ ਹੈਗੇ ਓਨੇ ਅਤੇ ਇਹਦੇ 'ਚ ਸਾਨੂੰ ਇੰਨੀ ਜਿਹੜੀ ਲਿਪੀ ਦਿੱਤੀ ਹੋਈ ਹੈ ਉਹ ਲਿਪੀ ਦੇ ਵਿੱਚ ਸਾਡੇ ਕੋਲ ਬੜੀ ਸਾਰੀ ਸੁਤੰਤਰਤਾ ਹੈ ਜਿਸ ਦੇ 'ਚ ਅਸੀਂ ਆਪਣਾ ਜਿਹੜਾ ਮਨ ਦੇ ਭਾਵ ਨੇ ਹਾਵ ਭਾਵ ਨੇ ਉਹ ਬੜੇ ਆਰਾਮ ਨਾਲ ਲਿਖਤੀ ਰੂਪ 'ਚ ਅਤੇ ਬੋਲਣ ਦੇ ਰੂਪ ' ਅਸੀਂ ਦਰਸਾ ਸਕਦੇ ਹਾਂ ਪਲੱਸ ਜਿਹੜੀ ਆਪਣੀ ਖੇਤਰੀ ਭਾਸ਼ਾ ਹੈ ਉਹ ਸਾਨੂੰ ਇਹ ਆਜ਼ਾਦੀ ਦਾ ਮੌਕਾ ਦਿੰਦੀ ਆ ਵੀ ਹਾਂ ਅਸੀਂ ਜੋ ਆਪਣੇ ਮਨ ਦੇ ਭਾਵ ਨੇ ਉਹਨਾਂ ਨੂੰ ਲਿਖਤੀ ਰੂਪ 'ਚ ਜਾਂ ਪੜ੍ਹਨ ਦੇ ਰੂਪ 'ਚ ਜਾਂ ਕਿਸੇ ਵੀ ਤਰੀਕੇ ਨਾਲ ਅਸੀਂ ਚਾਹੀਏ ਤਾਂ ਉਹਨੂੰ ਉਚਾਰਨ ਜਾਂ ਲਿਖ ਕੇ ਜਾਂ ਕਿਸੇ ਤਰ੍ਹਾਂ ਨਾਲ ਅਸੀਂ ਪ੍ਰਗਟ ਕਰ ਸਕਦੇ ਹਾਂ